ਹਾਂਜੀ ਮੈਂ ਅੱਜ ਤੱਕ ਕੋਈ ਵੀ ਲੋਨ ਨਹੀਂ ਲਿੱਤਾ ਕਿਉਂਕਿ ਮੈਨੂੰ ਅੱਜ ਤੱਕ ਲੋਨ ਲੈਣ ਦੀ ਕੋਈ ਜ਼ਰੂਰਤ ਨਹੀਂ ਪਈ ਮੇਰਾ ਇੱਦਾਂ ਹੀ ਕੰਮ ਚੱਲ ਰਿਹਾ ਹੈ ਇਸ ਲਈ ਮੈਂ ਕਦੇ ਵੀ ਇਸ ਲੋਨ ਦੇ ਲੋਨ ਲੈਣ ਦੇ ਚੱਕਰਾਂ ਦੇ ਵਿੱਚ ਨਹੀਂ ਪਈ ਪਈ ਹਾਂ ਹਾਂ ਮੇਰੀ ਇੱਕ ਫਰੈਂਡ ਹੈ ਉਹਨਾਂ ਨੇ ਲੋਨ ਲਿੱਤਾ ਸੀ ਕਿਉਂਕਿ ਉਸਨੇ ਵਿਦੇਸ਼ 'ਚ ਪੜ੍ਹਾਈ ਕਰਨ ਦੇ ਲਈ ਜਾਣਾ ਸੀ ਉਸ ਦੇ ਲਈ ਉਸਨੂੰ ਲੋਨ ਲੈਣ ਦੀ ਜ਼ਰੂਰਤ ਪਈ ਤਾਂ ਉਸਨੇ ਮੈਨੂੰ ਦੱਸਿਆ ਉਸਨੇ ਮੈਨੂੰ ਥੋੜ੍ਹੀ ਬਹੁਤੀ ਜਾਣਕਾਰੀ ਦਿੱਤੀ ਸੀ ਕਿ ਉਸਨੇ ਲੋਨ ਚਾਲੀ ਲੱਖ ਰੁਪਏ ਦਾ ਲਿਆ ਹੈ ਕਿਉਂਕਿ ਉਸਨੇ ਜੋ ਸਟੂਡੈਂਟਸ ਇਸ ਲਈ ਉਸਨੇ ਸਟੱਡੀ ਦੇ ਲਈ ਸਟੱਡੀ ਵੇਸਟ ਵੀਜ਼ਾ ਲਗਵਾਉਣਾ ਸੀ ਉਸ ਦੇ ਲਈ ਉਹਨੇ ਸਟੱਡੀ ਦੇ ਲਈ ਚਾਲੀ ਲੱਖ ਰੁਪਏ ਲੋਨ ਬੈਂਕ ਤੋਂ ਲਿੱਤਾ ਸੀ ਜਿਸਦੇ ਕਾਰਨ ਚੱਲਦੇ ਹੋਏ ਉਸਨੂੰ ਵੀ ਕੋਈ ਵੀ ਚੀਜ਼ ਗਿਰਵੀ ਨਹੀਂ ਰੱਖਣੀ ਪਈ ਕਿਉਂਕਿ ਉਹ ਸਟੱਡੀ ਸਟੱਡੀ ਲੋਨ ਸੀ ਇਸ ਲਈ ਉਸਨੂੰ ਕੋਈ ਵੀ ਚੀਜ਼ ਗਿਰਵੀ ਨਹੀਂ ਅਗਰ ਉਹ ਚਾਲੀ ਲੱਖ ਤੋਂ ਉੱਪਰ ਲੋਨ ਲੈਂਦੀ ਸੀ ਤਾਂ ਉਸ ਨੂੰ ਕੋਈ ਨਾ ਕੋਈ ਚੀਜ਼ ਗਿਰਵੀ ਰੱਖਣੀ ਪੈਣੀ ਸੀ ਆਪਣੀ ਜਿਵੇਂ ਜ਼ ਜ਼ਮੀਨ ਜਾਇਦਾਦ ਜਾਂ ਕੋਈ ਸੋਨੇ ਦੋ ਗਹਿਣੇ ਇਸ ਲਈ ਉਸਨੇ ਕੋਈ ਚੀਜ਼ ਗਿਰਵੀ ਨਹੀਂ ਰੱਖੀ ਤਾਂ ਉਸਨੇ ਇਜੀਲੀ ਉਸ ਨੂੰ ਆਸਾਨੀ ਨਾਲ ਬਹੁਤ ਹੀ ਆਸਾਨੀ ਨਾਲ ਬੈਂਕ ਤੋਂ ਲੋਨ ਲੈ ਲਿਆ ਕਿਉਂਕਿ ਥੋੜ੍ਹੀ ਬਹੁਤ ਤਾਂ ਮੁਸ਼ਕਲ ਉਸਨੂੰ ਆਈ ਬਟ ਉਹ ਥੋੜ੍ਹੀ ਬਹੁਤ ਮੁਸ਼ਕਲ ਤੋਂ ਬਾਅਦ ਉਸ ਨੂੰ ਆਸਾਨੀ ਨਾਲ ਇੱਕ ਲੋਨ ਮਿਲ ਗਿਆ ਸੀ ਜਿਸ ਦੇ ਚੱਲਦੇ ਦੌਰਾਨ ਉਹ ਆਪਣਾ ਵੀਜ਼ਾ ਲਗਵਾ ਕੇ ਬਾਹਰ ਚਲੀ ਗਈ ਹੈ ਇਹ ਪਿੰਡ ਦ ਅਤੇ ਇਹ ਪੇਂਡੂ ਪੇਂਡੂ ਖੇਤਰ ਦੇ ਵਿਦਿਆਰਥੀਆਂ ਲਈ ਬਹੁਤ ਜ਼ਿਆਦਾ ਲਾਭਦਾਇਕ ਹੈ ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਕਿ ਕਿਸਾਨ ਹੁੰਦੇ ਜਿਹੜੇ ਉਹਨਾਂ ਦੀ ਫਸਲਾਂ ਕੀ ਡੁੱਂਬ ਜਾਂਦੀਆਂ ਨੇ ਜਿਹਨਾਂ ਦੇ ਚੱਲਦੇ ਦੌਰਾਨ ਉਹਨਾਂ ਕੋਲ ਕੋਈ ਪੈਸਾ ਨਹੀਂ ਹੁੰਦਾ ਉਸਨੂੰ ਘਰ ਖਰਚ ਚਲਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਸ ਦੇ ਲਈ ਫਿਰ ਉਹ ਬੱਚੇ ਜੋ ਆਪਣੇ ਸਟੱਡੀ ਵੀ ਰੋਕ ਸਟੱਡੀ ਵੀ ਨਹੀਂ ਕਰਵਾ ਸਕਦੇ ਇਸ ਲਈ ਬੱਚੇ ਸਟ ਅੱਗੇ ਪੜ੍ਹਨਾ ਚਾਹੁੰਦੇ ਨੇ ਤਾਂ ਫਿਰ ਉਹ ਇਹ ਸਟੱਡੀ ਲੋਨ ਲੈ ਕੇ ਆਪਣੀ ਪੜ੍ਹਾਈ ਅੱਗੇ ਵਧਾ ਸਕਦੇ ਨੇ ਵੀ ਆਪਣੀ ਪੜ੍ਹਾਈ ਨਹੀਂ ਰੋਕ ਸਕਦੇ ਤਾਂ ਉਹ ਆਪਣੀ ਪੜ੍ਹਾਈ ਨੂੰ ਇੱਦਾਂ ਲੋਨ ਲੈ ਕੇ ਅੱਗੇ ਕੰਟੀਨਿਊ ਕਰਦੇ ਰਹਿੰਦੇ ਨੇ ਪੜ੍ਹਦੇ ਰਹਿੰਦੇ ਨੇ ਜਿਸ ਦੇ ਦੌਰਾਨ ਉਹ ਉਹਨਾਂ ਲਈ ਇਹ ਬਹੁਤ ਜ਼ਿਆਦਾ ਲਾਭਦਾਇਕ ਹੈ ਕਈ ਕਈ ਬੱਚੇ ਇੱਦਾਂ ਦੇ ਹੁੰਦੇ ਹਨ ਜਿਹਨਾਂ ਦੇ ਘਰ ਦੇ ਮਜ਼ਦੂਰੀ ਕਰਦੇ ਹਨ ਅਤੇ ਉਹ ਆਪਣੇ ਬੱਚਿਆਂ ਦਾ ਖਰਚਾ ਜ਼ਿਆਦਾਤਰ ਸਕੂਲਾਂ ਤੱਕ ਹੀ ਉਠਾ ਸਕਦੇ ਨੇ ਸਕੂਲਾਂ ਤੋਂ ਅੱਗੇ ਕੋਲਜਾਂ 'ਚ ਨਹੀਂ ਪੜ੍ਹਾ ਸਕਦੇ ਜਿਸ ਦੇ ਦੌਰਾਨ ਉਹ ਸਟੱਡੀ ਲੋਨ ਲੈ ਲੈਂਦੇ ਨੇ ਉਸ ਤੋਂ ਬਾਅਦ ਬੱਚਿਆਂ ਦੀ ਪੜ੍ਹਾਈ 'ਤੇ ਉਹ ਪੈਸਿਆਂ ਨੂੰ ਖਰਚ ਕਰ ਦਿੰਦੇ ਨੇ ਹਨ ਅਤੇ ਇਸ ਲਈ ਉਹਨਾਂ ਨੂੰ ਬਹੁਤ ਬਹੁਤ ਜ਼ਿਆਦਾ ਫਾਇਦੇਮੰਦ ਇਹ ਲੋਨ ਲੱਗਦਾ ਹੈ ਇਸ ਲਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬੱਚੇ ਪੇਂਡੂ ਖੇਤਰਾਂ ਦੇ ਬੱਚੇ ਨੂੰ ਬਹੁਤ ਜ਼ਿਆਦਾ ਸਕੀਮ ਦਾ ਲਾਭ ਉਠਾਉਂਦੇ ਹਨ